ਹਾਂਜੀ ਸ਼ਰ ਰੇਲਵੇ ਸਟੇਸ਼ਨ ਤੋਂ ਬੋਲਦੇ ਹੋ ਜੀ ਹਾਂਜੀ ਸਰ ਰੇਲਵੇ ਸਟੇਸ਼ਨ ਤੋਂ ਜੀ ਸਰ ਇਹ ਮੈਂ ਮੈਂ ਇੱਕ ਜਾਣਾ ਜੀ ਅੰਮ੍ਰਿਤਸਰ ਜਾਣਾ ਜੀ ਮੈਂ ਦੋ ਦਿਨ ਬਾਅਦ ਜਾਣਾ ਜੀ ਮੈਂ ਰਿਜਰਵੇਸ਼ਨ ਕਰਵਾਉਣੀ ਹੈ ਜੀ ਹਾਂਜੀ ਹਾਂਜੀ ਹਾਂਜੀ ਮੈਨੂੰ ਥੋੜ੍ਹਾ ਉਹਦੇ ਬਾਰੇ ਡਿਟੇਲ 'ਚ ਦੱਸਿਓ ਜੀ ਕਿੰਨੇ ਟੈਮ ਤੱਕ ਪਹੁੰਚ ਜੂਗੀ ਜੀ ਅਤੇ ਕਿਹੜੇ ਕਿਹੜੇ ਰਸਤੇ 'ਚ ਆਉਣਗੇ ਸਟੋਪੇਜ ਵਗੈਰਾ ਅਤੇ ਹਾਂਜੀ ਹਾਂਜੀ ਇਹ ਕਿਹੜਾ ਵਾਇਆ ਜਾਵੇਗੀ ਜੀ ਕਿਹੜੇ ਸ਼ਹਿਰ ਤੋਂ ਹੋ ਕੇ ਜੀ ਇਹ ਬਠਿੰਡੇ ਤੋਂ ਹੋ ਕੇ ਇੱਧਰ ਜਾਵੇਗੀ ਜੀ ਫਿਰੋਜ਼ਪੁਰ ਅਤੇ ਇੱਧਰ ਮੈਨੂੰ ਸਿੱਧਾ ਨਹੀਂ ਮਿਲਣੀ ਜੀ ਫਾਜ਼ਿਲਕਾ ਤੋਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਇੱਧਰ ਜੀ ਹਾਂਜੀ ਅਤੇ ਮੈਨੂੰ ਫੇਰ ਉਹ ਉਹ ਦੱਸੋ ਉਹਦਾ ਟੈਮ ਦੱਸੋ ਜਿਹੜੀ ਸਿੱਧਾ ਜਾਂਦੀ ਹੈ ਫਾਜ਼ਿਲਕਾ ਤੋਂ ਮੈਂ ਬੈਠਾ ਅਤੇ ਸਿੱਧਾ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਅੱਛਾ ਇਹ ਸਵੇਰੇ ਪੰਜ ਵਜੇ ਇਹ ਕਿੰਨੇ ਕਿੰਨੇ ਟੈਮ 'ਚ ਮਤਲਬ ਪਹੁੰਚਦੀ ਉੱਥੇ ਕਿੰਨਾ ਟੈਮ ਲੱਗ ਜਾਂਦਾ ਹੈ ਪੰਜ ਘੰਟੇ 'ਚ ਜੀ ਅਤੇ ਰਸਤੇ 'ਚ ਕਿੱਥੇ ਕਿੱਥੇ ਰੁੱਕਦੀ ਹੈ ਕਿਹੜੇ ਕਿਹੜੇ ਮਤਲਬ ਸਟੋਪੇਜ ਹੁੰਦੇ ਆ ਅਤੇ ਕੁਛ ਦੱਸੋ ਹਾਂਜੀ ਅੱਛਾ ਜੀ ਇਹਦੇ 'ਤੇ ਟਾਈਮ ਜ਼ਿਆਦਾ ਲੱਗਦਾ ਜਾਂ ਐਨ ਜਾਂ ਜੇ ਕੋਈ ਟ੍ਰੇਨ ਹੈਗੀ ਹੈ ਜਿਹਦੇ 'ਤੇ ਥੋੜ੍ਹਾ ਘੱਟ ਲੱਗਦਾ ਹੋਏ ਅਤੇ ਸਟੋਪੇਜ ਜ਼ਿਆਦਾ ਨਾ ਹੋਣ ਹਾਂਜੀ ਉਹਦੇ ਸਟੋਪੇਜ ਨਹੀਂ ਹੋਣਗੇ ਜ਼ਿਆਦਾ ਜੀ ਹਾਂਜੀ ਅਤੇ ਉਹ ਤਾਂ ਫਿਰ ਟਾਈਮ ਦਾ ਵੀ ਫਰਕ ਪੈ ਜੂਗਾ ਜੀ ਅੱਛਾ ਉਹ ਸਾਢੇ ਤਿੰਨ 'ਚ ਇਹ ਪੰਜ ਘੰਟੇ 'ਚ ਲਾਉਂਦੀ ਹੈ ਜੀ ਅੱਛਾ ਜੀ ਉਹ ਫੇਰ ਸਹੀ ਹੈ ਜੀ ਪੰਜ ਮੈਂ ਉਹ ਬੁਕਿੰਗ ਕਰਵਾਉਣੀ ਹੈ ਜੀ ਜਿਹੜੀ ਸਾਢੇ ਤਿੰਨ ਘੰਟੇ 'ਚ ਲਾਉਂਦੀ ਹੈ

ਅੱਛਾ ਡੇਢ ਸੌ ਜੀ ਅਤੇ ਦੂਸਰੀ ਦਾ ਕਿੰਨਾ ਹੈ ਜੀ ਉਹਦਾ ਇੱਕ ਸੌ ਸੱਤਰ ਰੁਪਏ ਜੀ ਹਾਂਜੀ ਹਾਂਜੀ ਤਾਂ ਹੀ ਤਾਂ ਪੁੱਛ ਰਿਹਾ ਜੀ ਇੱਕ ਸੌ ਤੀਹ ਉਹ ਡੇਢ ਸੌ ਜੀ ਹਾਂਜੀ ਅਤੇ ਜੇ ਸਲੀਪਰ ਕਰਵਾਉਣੀ ਹੋਏ ਤਾਂ ਫਿਰ ਉਹਦਾ ਕਿੰਨਾ ਕਿਰਾਇਆ ਜੀ ਅੱਛਾ ਅਤੇ ਤੁਸੀਂ ਫਿਰ ਆ ਐਂ ਕਰੋ ਜੀ ਇੱਕ ਸਲੀਪਰ ਫਿਰ ਬੁੱਕ ਕਰ ਦਿਓ ਜੀ ਅੰਮ੍ਰਿਤਸਰ ਅਤੇ ਹਾਂਜੀ

ਮੇਰਾ ਨਾਂ ਹੈ ਜੀ ਹੀ ਨਵਦੀਪ ਰਾਜ ਦੇ ਨਾਂ ਤੋਂ ਕਰ ਦਿਓ

ਹਾਂਜੀ ਹਾਂਜੀ ਉਹੀ ਬਾਰ੍ਹਾਂ ਵਜੇ ਵਾਲੀ ਕਰ ਦਿਓ ਜੀ ਓਕੇ ਥੈਂਕ ਊ